ਮੈਂ ਪਟਿਆਲਾ ਸ਼ਹਿਰ ਵਿੱਚ ਰਹਿੰਦੀ ਹਾਂ ਪਟਿਆਲਾ ਸ਼ਹਿਰ ਵੱਡਾ ਹੋਣ ਕਰਕੇ ਗਰੀਬੀ ਅਤੇ ਬੇਰੁਜ਼ਗਾਰੀ ਬਹੁਤ ਹੈ ਕਈ ਲੋਕ ਬੇਰੁਜ਼ਗਾਰੀ ਕਰਕੇ ਚੋਰੀਆਂ ਠੱਗੀਆਂ ਕਰਨ ਲੱਗ ਗਏ ਹਨ ਜਿਵੇਂ ਕਿ ਕੋਈ ਔਰਤ ਨੇ ਸੋਨੇ ਦੀ ਚੈਨ ਪਾਈ ਹੋਈ ਹੈ ਤਾਂ ਉਹ ਚੈਨ ਉਤਾਰ ਕੇ ਲੈ ਜਾਂਦੇ ਹਨ ਕਈ ਦਕਾਨਾਂ 'ਤੇ ਜਿਵੇਂ ਬੈਟਰੀਆਂ ਵਗੈਰਾ ਹੁੰਦੀਆਂ ਨੇ ਬੈਟਰੀਆਂ ਚੋਰੀ ਕਰਕੇ ਲੈ ਜਾਂਦੇ ਹਨ ਰਾਤ ਨੂੰ ਦੁਕਾਨਾਂ ਵਿੱਚ ਜਿਨ੍ਹਾਂ ਲੋਕਾਂ ਦੇ ਗੱਲਿਆਂ ਵਿੱਚ ਪੈਸੇ ਪਏ ਹੁੰਦੇ ਹਨ ਉਹਨਾਂ ਨੂੰ ਵੀ ਚੋਰੀ ਕਰਕੇ ਲੈ ਜਾਂਦੇ ਨੇਗੇ ਕਰਕੇ ਬੇਰੁਜ਼ਗਾਰੀ ਕਰਕੇ ਬਹੁਤ ਹੀ ਜ਼ਿਆਦਾ ਚੋਰੀਆਂ ਕਰਨ ਲੱਗ ਗਏ ਨੇਗੇ ਅਤੇ ਮੇਰੀ ਸਰਕਾਰ ਨੂੰ ਇਹ ਅਪੀਲ ਹੈ ਕਿ ਉਹ ਜਿਹੜੇ ਬੇਰੁਜ਼ਗਾਰ ਨੇਗੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਤਾਂ ਕਿ ਜਿਹੜੇ ਨਿਰਦੋੋਸ਼ ਨੇਗੇ ਉਹਨਾਂ ਦਾ ਚੋਰੀਆਂ ਤੋਂ ਬਚਾ ਹੋ ਸਕੇ